ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਆਰਤੀ ਹੈ ਮੈਂ ਪਠਾਨਕੋਟ ਦੇ ਇੱਕ ਛੋਟੇ ਜਿਹੇ ਪਿੰਡ ਢੇਸੀਆਂ ਤੋਂ ਬਲੋਂਗ ਕਰਦੀ ਐਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਐਂ ਕਿ ਮੈਨੂੰ ਮੈਨੂੰ ਕੱਪੜਿਆਂ ਵਿੱਚ ਮੇਰੀ ਇੱਕ ਛੋਟੀ ਜਿਹੀ ਬੁਟੀਕ ਹੈ ਮੇਰੀ ਢੇਸੀਆਂ ਪਿੰਡ ਵਿੱਚ ਤਾਂ ਕਿ ਉੱਥੇ ਮੇਰਾ ਬਹੁਤ ਸਾਰਾ ਅੱਛਾ ਕੰਮ ਚੱਲਦਾ ਪਿਆ ਜ਼ਿਆਦਾ ਕੰਮ ਤਾਂ ਕਰਵਾ ਚੌਥ ਨੂੰ ਹੀ ਚੱਲਦਾ ਪਿਆ ਹੈ ਜਿਸ ਤਰ੍ਹਾਂ ਕਿ ਮੈਨੂੰ ਕੱਪੜੇ ਸਿਊਣਾ ਬੜੇ ਅੱਛੇ ਲਗਦੇ ਹੈ ਮੇਰੇ ਕਸਟਮਰ ਮੇਰੇ ਕੋਲੋਂ ਡੇਲੀ ਸੂਟ ਛੱਡ ਕੇ ਜਾਂਦੇ ਹੈ ਔਰ ਮੈਂ ਤਾਂ ਆਪਣੀ ਸਿਲਾਈ ਖੁਦ ਕਰਨਾ ਚਾਹੁੰਦੀ ਐਂ

ਜਿਸ ਤਰ੍ਹਾਂ ਕਿ ਜ਼ਿਆਦਾ ਟੱਫ ਸੂਟ ਮੈਨੂੰ ਇਸ ਤਰ੍ਹਾਂ ਲਗਦਾ ਹੈ ਜੋ ਮੋਤੀਆਂ ਵਾਲਾ ਉਹਨੂੰ ਮੈਂ ਬਹੁਤ ਹੀ ਤਰੀਕੇ ਨਾਲ ਸੀਤਾ ਹੈ ਜਿਸ ਦਿਨ ਦਾ ਟਾਇਮ ਦਿੱਤਾ ਹੋਵੇ ਉਸ ਦਿਨ ਦਾ ਹੀ ਮੈਂ ਪੂਰਾ ਕਰਕੇ ਉਸ ਨੂੰ ਆਪਣੇ ਗ੍ਰਾਹਕ ਨੂੰ ਦਿੱਤਾ ਹੈਗਾ ਹੈ ਇਸ ਕਰਕੇ ਮੈਨੂੰ ਬਹੁਤ ਜ਼ਿਆਦਾ ਕੰਮ ਕਰਨਾ ਅੱਛਾ ਲੱਗਦਾ ਹੈ ਸਿਲਾਈ ਦਾ